ਹੈਲੋ ਹਾਂਜੀ ਸਤਿ ਸ਼੍ਰੀ ਅਕਾਲ

ਹਾਂਜੀ ਹਾਂਜੀ ਹਾਂਜੀ ਜ਼ਰੂਰ ਮੈਂ ਦੱਸੂੰਗੀ ਇੱਥੇ ਸਭ ਤੋਂ ਪਹਿਲਾਂ ਆਪਾਂ ਟਿੱਲਾ ਬਾਬਾ ਫ਼ਰੀਦ ਜੀ ਦੀ ਹਿਸਟਰੀ ਬਾਰੇ ਦੱਸਦੀ ਜਿਹੜੇ ਪੰਜਾਬ ਦੇ ਫਰੀਦਕੋਟ ਦੇ ਜ਼ਿਲ੍ਹੇ 'ਚ ਬੜਾ ਫੇਮਸ ਹੈ ਜਿੰਨੂੰ ਗੋਦੜੀ ਸਾਹਿਬ ਵੀ ਕਹਿਦੇ ਹਾਂ ਠੀਕ ਹੈ ਅਤੇ ਜਿਹੜਾ ਇਹਦੀ ਨਾਂ ਜਿਹੜਾ ਫ਼ਰੀਦ ਬਾਬਾ ਫ਼ਰੀਦ ਜੀ ਦੇ ਨਾਂ ਕਰਕੇ ਪਿਆ ਸੀ ਜਦੋਂ ਬਾਬਾ ਫ਼ਰੀਦ ਜੀ ਠੀਕ ਹੈ ਇਸ ਸ ਸਿਟੀ ਵਿੱਚ ਰੁਕੇ ਸੀ ਤਾਂ ਉਦੋਂ ਇਹਦਾ ਨਾਮ ਮੋਕਲਪੁਰ ਸੀ ਚਾਲੀ ਦਿਨਾਂ ਲਈ ਕਿੰਗ ਮੋਕਲ ਜਿਹੜਾ ਕਿ ਰਾਜਾ ਸੀ ਮੋਕਲ ਫਰੀਦਕੋਟ ਦਾ ਹੈ ਨਾ ਅਤੇ ਉਨ੍ਹਾਂ ਦੇ ਨੇੜੇ ਤੇੜੇ ਹੀ ਰੁਕੇ ਸੀ ਦੇ ਟਾਈਮ ਫਿਰ ਜਦੋਂ ਚਾਲੀ ਦਿਨ ਰੁਕੇ ਉਸ ਤੋਂ ਬਾਅਦ ਇਹਦਾ ਨਾਮ ਫਰੀਦਕੋਟ ਪਿਆ ਸੀ ਉਸ ਤੋਂ ਬਾਅਦ ਇੰਨੇ ਇੰਪਰੈਸ ਹੋ ਗਏ ਸੀ ਬਾਬਾ ਫ਼ਰੀਦ ਤੋਂ ਇਹਦਾ ਨਾਂ ਫਿਰ ਉਨ੍ਹਾਂ ਟਿੱਲਾ ਬਾਬਾ ਫ਼ਰੀਦ ਜੀ ਰੱਖਤਾ ਸੀ ਠੀਕ ਹੈ ਇਹ ਮਤਲਬ ਬਾਬਾ ਫ਼ਰੀਦ ਜੀ ਜਦੋਂ ਬਾਰ੍ਹਾਂ ਸੌ ਪੰਦਰਵੀਂ ਸਦੀ ਵਿੱਚ ਜਦੋਂ ਸਿਟੀ ਨੂੰ ਵਿਜਿਟ ਕੀਤਾ ਸੀ ਹੈ ਨਾ ਉਸ ਤੋਂ ਬਾਅਦ ਹੀ ਇਹਦਾ ਨਾਂ ਪਿਆ ਸੀ ਉਸ ਤੋਂ ਬਾਅਦ ਇਹਦੇ 'ਤੇ ਗੁਰਦਵਾਰੇ ਦਰਗਾਹਾਂ ਵੀ ਕਾਫ਼ੀ ਬਣੀਆਂ ਠੀਕ ਹੈ ਇਸ ਮਤਲਬ ਰੂਪ ਭੇਟਾ ਫਿਰ ਇਹਦੇ ਰਿਲੇਟਡ ਫੈਸਟੀਵਲਜ ਵੀ ਕਈ ਤਰ੍ਹਾਂ ਦੇ ਮਨਾਏ ਜਾਂਦੇ ਵੇ ਸਤੰਬਰ ਵਿੱਚ ਮੇਲਾ ਲੱਗਦਾ ਆਪਣਾ ਬਾਬਾ ਫ਼ਰੀਦ ਜੀ ਦਾ ਇੱਕੀ ਬਾਈ ਤੇਈ ਤਰੀਕ ਦਾ ਹੈ ਨਾ ਅਤੇ ਮਤਲਬ ਉਹਦੀ ਕਾਫ਼ੀ ਦਰਬਾਰ ਵਗੈਰਾ ਲੱਗਦੇ ਹੈ ਠੀਕ ਹੈ ਸਮਾਗਮ ਬੜੇ ਕੀਤੇ ਜਾਂਦੇ ਹੈ ਠੀਕ ਹੈ ਫਿਰ ਜਦੋਂ ਬਾਬਾ ਫ਼ਰੀਦ ਜੀ ਤੇਰਵੀਂ ਸਦੀ 'ਚ ਸੂਫ਼ੀ ਸ਼ਰਾਮ ਡੈਡੀਕੇਟ ਕੀਤਾ ਸੀ ਪਾਕ ਪੱਤਣ ਪੰਜਾਬ ਪਾਕਿਸਤਾਨ ਤੋਂ ਉਸ ਤੋਂ ਬਾਅਦ ਹਾਂਜੀ ਬਹੁਤ ਵਧੀਆ ਜਗ੍ਹਾ ਹੈਗੀ ਤੁਸੀਂ ਜ਼ਰੂਰ ਵਿਜਿਟ ਕਰਿਓ ਬਹੁਤ ਵਧੀਆ ਲੱਗੇਗਾ ਅਤੇ ਮਤਲਬ ਇਹਦਾ ਨਾਂ ਵੀ ਕਾਫ਼ੀ ਫੇਮਸ ਇਹਦੇ ਹੋਰ ਵੀ ਹਿਸਟੋਰੀਕਲ ਪਲੇਸ ਜਗ੍ਹਾ ਰੈਸਟ ਹਾਊਸ ਹੈਗੇ ਦੇਖਣ ਨੂੰ ਨੇੜੇ ਤੇੜੇ ਤੁਹਾਡੇ ਕੋਲ ਹੈ ਨਾ ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਬਾਬਾ ਫ਼ਰੀਦ ਵੀ ਆ ਸਕਦੇ ਹੋ ਗੋਦੜੀ ਸਾਹਿਬ ਵੀ ਜਾ ਸਕਦੇ ਇਹ ਮੇਰੇ ਨੇੜੇ ਹੈਗੇ ਆ ਸਥਾਨ ਘੁੰਮਣ ਲਈ ਹਾਂਜੀ ਹਾਂਜੀ ਗੋਦੜੀ ਸਾਹਿਬ ਬਾਰੇ ਦੱਸੋ ਵੀ ਇਨ੍ਹਾਂ ਦਾ ਨਾਂ ਵੀ ਬਾਬਾ ਫ਼ਰੀਦ ਜੀ ਤੋਂ ਹੀ ਪਿਆ ਸੀ ਓਮੀ ਅਤੇ ਫਿਰ ਜਦੋਂ ਹਾਂਜੀ ਬਾਰ੍ਹਾਂ ਸੌ ਪੰਦਰਵੀਂ ਸਦੀ 'ਚ ਆਏ ਸੀ ਜਦੋਂ ਫਿਰ ਉਹ ਹੀ ਉਨ੍ਹਾਂ ਦੇ ਹੀ ਨਾਂ ਤੋਂ ਜਦੋਂ ਚਾਲੀ ਦਿਨ ਮੋਕਲ ਨਾਂ ਦੇ ਕਿੰਗ ਕੋਲ ਰੁਕੇ ਸੀ ਉਸ ਤੋਂ ਇੰਨੇ ਇੰਪਰੈਸ ਹੋ ਗਏ ਤਾਂ ਉਨ੍ਹਾਂ ਟਿੱਲਾ ਬਾਬਾ ਫ਼ਰੀਦ ਜੀ ਰੱਖਿਆ ਸੀ ਹਾਂਜੀ ਹਾਂਜੀ ਥੈਂਕਿ ਯੂ ਓਕੇ